ਪੰਜਾਬ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਰਕਾਰੀ ਸੁਧਾਰ ਹੈਗਾ ਉਹ ਸਿਹਤ ਪ੍ਰਣਾਲੀ ਦੇ ਵਿੱਚ ਕਰਨਾ ਚਾਹੀਦਾ ਹੈਗਾ ਮੇਰੇ ਹਿਸਾਬ ਨਾਲ ਸਿਹਤ ਪੱਖੋਂ ਜਿਵੇਂ ਜਿਹੜੀਆਂ ਸਿਹਤ ਸੰਬੰਧੀ ਕੀ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਸਭ ਤੋਂ ਵੱਧ ਸਮੱਸਿਆਵਾਂ ਆ ਰਹੀਆਂ ਨੇ ਹੈ ਨਾ ਪੰਜਾਬ ਕੀ ਭਾਰਤ ਕੀ ਪੂਰੀ ਦੁਨੀਆਂ ਦੇ ਵਿੱਚ ਲੋਕ ਕੀ ਨੇ ਸਿਹਤ ਪੱਖੋਂ ਕੀ ਹੈ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵੀ ਜ਼ਿਆਦਾ ਪੀੜਤ ਨੇ ਇਸ ਪੱਖੋਂ ਹੈ ਨਾ ਸਰਕਾਰੀ ਸੁਧਾਰ ਇਹ ਚਾਹੀਦਾ ਕਿ ਜਿਹੜਾ ਸਟਾਫ ਹੈਗਾ ਹੈ ਨਾ ਵੀ ਜਿਹੜਾ ਹਸਪਤਾਲ ਦੇ ਵਿੱਚ ਜਿਹੜਾ ਸਾਨੂੰ ਸਟਾਫ ਆ ਉਹ ਪੂਰਾ ਮੁਹੱਈਆ ਹੋਣਾ ਚਾਹੀਦਾ ਹੈਗਾ ਵੀ ਜਦੋਂ ਕੋਈ ਵੀ ਐਮਰਜੈਂਸੀ ਪੈਂਦੀ ਹੈ ਤਾਂ ਉੱਥੇ ਹਰ ਡਾਕਟਰ ਜਾਂ ਕੋਈ ਵੀ ਡਾਕਟਰ ਆ ਜਿਹੜਾ ਜਿਹੜਾ ਸਟਾਫ ਉਹ ਪੂਰਾ ਤੁਰੰਤ ਮੌਜੂਦ ਹੋਵੇ ਚੌਵੀ ਘੰਟੇ ਸਰਵਿਸ ਹੋਣੀ ਚਾਹੀਦੀ ਹੈਗੀ ਠੀਕ ਹੈ ਅਤੇ ਜਿਵੇਂ ਹਸਪਤਾਲ ਦੇ ਵਿੱਚ ਕੀ ਆ ਜਿਹੜੀ ਸਫਾਈ ਦਾ ਜਿਹੜਾ ਜਿਹੜੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਹੈਗੇ ਜਿਹੜਾ ਸਟਾਫ ਆ ਉਹ ਪ੍ਰੋਪਰ ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਪੂਰੀ ਆਏਂ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਹੈਗੀ ਜੇ ਕੋਈ ਵੀ ਪੀੜਤ ਬੰਦਾ ਉੱਥੇ ਹਸਪਤਾਲ ਪਹੁੰਚਦਾ ਐਮਰਜੈਂਸੀ ਦੇ ਵਿੱਚ ਤਾਂ ਨਾਲ ਦੀ ਨਾਲ ਕੀ ਉਸ ਦਾ ਹੱਲ ਹੋਣਾ ਚਾਹੀਦਾ ਹੈਗਾ ਅਤੇ ਦੂਜੀ ਗੱਲ ਇਹ ਹੈ ਕਿ ਸਰਕਾਰੀ ਜਿਹੜੇ ਜਿਵੇਂ ਫੀਸਾਂ ਜਿਹੜੀਆਂ ਦਵਾਈਆਂ ਨੇ ਹੈ ਨਾ ਸਰਕਾਰੀ ਦਵਾਈਆਂ ਨੇ ਠੀਕ ਹੈ ਉਹ ਵੀ ਪ੍ਰੋ ਉਹ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਵੀ ਹਸਪਤਾਲ ਦੇ ਵਿੱਚ ਮਰੀਜ਼ ਨੂੰ ਕੀ ਹੈ ਕੋਈ ਵੀ ਦਿੱਕਤ ਨਾ ਆਵੇ ਜੇ ਉਹ ਕੱਲ੍ਹ ਨੂੰ ਦਵਾਈ ਲੈਣ ਵੀ ਜਾਂਦਾ ਹੈਗਾ ਅਤੇ ਦੂਜੀ ਗੱਲ ਕੀ ਹੈ ਜਿਵੇਂ ਹੁਣ ਜਿਵੇਂ ਡਾਕਟਰ ਨੂੰ ਮਿਲਣਾ ਹੁੰਦਾ ਆਪਾਂ ਸਰਕਾਰੀ ਡਾਕਟਰ ਨੂੰ ਚੈੱਕਅਪ ਕਰਾਉਣਾ ਹੈਗਾ ਤਾਂ ਆਪਾਂ ਨੂੰ ਲਾਈਨਾਂ ਦੇ ਵਿੱਚ ਖੜ੍ਹਨਾ ਪੈਂਦਾ ਲੈਨ ਦੇ ਵਿੱਚ ਹੈ ਨਾ ਕਤਾਰ ਦੇ ਵਿੱਚ ਖੜ੍ਹਨਾ ਪੈਂਦਾ ਪਹਿਲਾਂ ਤਾਂ ਆਪਣੀ ਵਾਰੀ ਨਹੀਂ ਆਉਂਦੀ ਹੈਗੀ ਫਿਰ ਕਿਤੇ ਜਾ ਕੇ ਆਪਣੀ ਵਾਰੀ ਆਉਂਦੀ ਆ ਫਿਰ ਆਪਾਂ ਡਾਕਟਰ ਨਾਲ ਸਲਾਹ ਕਰਦੇ ਹਾਂ ਫਿਰ ਉਹ ਡਾਕਟਰ ਆ ਕੀ ਹੈ ਆਪਾਂ ਨੂੰ ਦਵਾਈਆਂ ਦੱਸਦਾ ਨਾ ਵੀ ਤੁਸੀਂ ਆਹ ਆਹ ਦਵਾਈਆਂ ਲੈਣੀਆਂ ਨੇ ਤਾਂ ਮਤਲਬ ਕਿ ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ ਨਾ ਵੀ ਇਹ ਸਾਰੀ ਪ੍ਰਕਿਰਿਆ ਹੈਗੀ ਹੈ ਨਾ ਵੀ ਇਹਦੇ ਵਿੱਚ ਕੀ ਹੈ ਇੱਕ ਸਿਸ ਸਿਸਟਮੈਟਿਕ ਹੋਣਾ ਚਾਹੀਦਾ ਇੱਕ ਲੜੀਵਾਰ ਕੀ ਹੈ ਮਤਲਬ ਕਿ ਸ ਪ੍ਰਬੰਧ ਹੋਣਾ ਚਾਹੀਦਾ ਵੀ ਜਿਹੜਾ ਆਮ ਜਿਹੜਾ ਇਨਸਾਨ ਆ ਹੈ ਨਾ ਵੀ ਉਹਨੂੰ ਕੋਈ ਇਹਦੇ 'ਤੇ ਦਿੱਕਤ ਨਾ ਆਵੇ ਹੈ ਨਾ ਵੀ ਜਦੋਂ ਵੀ ਆਵੇ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਉਹ ਆਰਾਮ ਨਾਲ ਆਵੇ ਨਾਲ ਦੀ ਨਾਲ ਉਹਦਾ ਹੱਲ ਹੋਵੇ ਹੈ ਨਾ ਸਮੱਸਿਆ ਦਾ ਹੱਲ ਹੋਵੇ ਅਤੇ ਉਹਨੂੰ ਸਾਰੀ ਜਿਹੜੀ ਪ੍ਰੋਪਰ ਹੈ ਨਾ ਜਿਹੜੀ ਜਾਣਕਾਰੀ ਮਿਲੀ ਹੈ ਨਾ ਜਿਹੜੀ ਉਹਨੂੰ ਸਹੂਲਤ ਹੈਗੀ ਉਹ ਮੁਹੱਈਆ ਕਰਾਈ ਜਾਵੇ ਜਿਹੜੀ ਆ ਜਿਹੜੀਆਂ ਦਵਾਈਆਂ ਨੇ ਹੈ ਨਾ ਉਹ ਬਾਹਲੀਆਂ ਮਹਿੰਗੀਆਂ ਨਾ ਹੋਣ ਜਿਹੜਾ ਕਿ ਆਮ ਬੰਦਾ ਕਰ ਸਕੇ ਹੈ ਨਾ ਜੇ ਕਿਸੇ ਦੀ ਜ਼ਿਆਦਾ ਸਮੱਸਿਆ ਵੱਧਦੀ ਹੈ ਸਰਕਾਰ ਲਈ ਜੋ ਵੀ ਮਤਲਬ ਕਿ ਜਿਵੇਂ ਹੁਣ ਆਹ ਕਾਰਡ ਇਹਦੇ ਪੰਜ ਲੱਖ ਵਾਲੇ ਜਿਹੜੇ ਕਾਰਡ ਨੇ ਹੈ ਨਾ ਪੰਜ ਸਾਲਾਂ ਵਾਲੇ ਜਾਂ ਸਰਕਾਰ ਨੇ ਬਹੁਤ ਸਾਰੇ ਮਤਲਬ ਇਹ ਕਾਰਡ ਧਾਰਕ ਆਪਣੇ ਆਮ ਜਨਤਾ ਲਈ ਉਹ ਭੇਜੇ ਹੋਏ ਨੇ ਮਤਲਬ ਕਿ ਉਪਰਾਲੇ ਕੀਤੇ ਹੋਏ ਨੇ ਜਿਹੜੇ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਵਧੀਆ ਉਪਰਾਲਾ ਹੈਗਾ ਤਾਂ ਇੱਧਰ ਵੀ ਮਤਲਬ ਕਿ ਧਿਆਨ ਦੇਣਾ ਚਾਹੀਦਾ ਹੈਗਾ ਮਤਲਬ ਕਿ ਸਿਹਤ ਪ੍ਰਣਾਲੀ ਤੋਂ ਛੱਡ ਕੇ ਹੋਰ ਵੀ ਬਹੁਤ ਸਾਰੇ ਨੇ ਜਿਵੇਂ ਨਿਆਂ ਪ੍ਰਣਾਲੀ ਦੇ ਵਿੱਚ ਜਿਵੇਂ ਅੱਜ ਕੱਲ੍ਹ ਕੀ ਹੈ ਰੇਪ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਨੇ ਹੈ ਨਾ ਇੱਧਰ ਵੀ ਮਤਲਬ ਰੇਪ ਕੇਸਿਸ ਨੂੰ ਲੈ ਕੇ ਵੀ ਮੈਂ ਕਹਿ ਸਕਦੀ ਹੈਗੀ ਇਹਦੇ 'ਤੇ ਠੋਸ ਮਤਲਬ ਕਿ ਇਹਦੀ ਸੱਤਰ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਹੋਣਾ ਚਾਹੀਦਾ ਹੈਗਾ ਇਹ ਜਿਹੜਾ ਆਹ ਮੁਜਰਮ ਦੀ ਜਿਹੜੀ ਸਜ਼ਾ ਸਖਤ ਹੋਣੀ ਚਾਹੀਦੀ ਹੈਗੀ ਵੀ ਸਿੱਧਾ ਤੁਸੀਂ ਉਹਨੂੰ ਫਾਂਸੀ ਦੀ ਸਜ਼ਾ ਹੀ ਦਿਓ ਮਤਲਬ ਕਿ ਬਹੁਤ ਸ ਸਾਰੇ ਜਿਹੜੇ ਸੁਧਾਰ ਨੇ ਧਿਆਨ ਯੋਗ ਦੇਣ ਵਾਲੇ ਨੇ ਜ਼ਿਆਦਾਤਰ ਕਿ ਇਹੀ ਹੈ ਕਿ ਇੱਕ ਔਰਤ ਦੀ ਜਿਹੜੀ ਸੁਰੱਖਿਆ ਹੈਗੀ ਹੈ ਨਾ ਸਭ ਤੋਂ ਵੱਧ ਜਿਹੜਾ ਮੁੱਖ ਵਿਸ਼ਾ ਇਹੀ ਹੈਗਾ ਵੀ ਪੰਜਾਬ ਦੇ ਵਿੱਚ ਕਿ ਪੂਰੇ ਦੁਨੀਆਂ ਦੇ ਵਿੱਚ ਕੀ ਇੱਕ ਔਰਤ ਸੁਰੱਖਿਅਤ ਹੋਣੀ ਚਾਹੀਦੀ ਹੈਗੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਨੇ